ਰੰਗੋਲੀ ਦੀਵਾਲੀ ਦੇ ਦਿਨਾਂ ਵਿੱਚ ਬਣਾਈ ਜਾਂਦੀ ਹੈ ਲੋਕ ਦੀਵਾਲੀ ਦੇ ਦਿਨਾਂ ਵਿੱਚ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਨ ਅਤੇ ਰਾਤ ਨੂੰ ਕੁੜੀਆਂ ਰੰਗੋਲੀ ਬਣਾਉਂਦੀਆਂ ਹਨ ਰੰਗੋਲੀ ਦਾ ਕੋਈ ਜ਼ਿਆਦਾ ਮਹੱਤਵ ਨਹੀਂ ਹੁੰਦਾ ਰੰਗੋਲੀ ਆਪਣੇ ਘਰਾਂ ਨੂੰ ਸਜਾਉਣ ਲਈ ਬਣਾਈ ਜਾਂਦੀ ਹੈ ਸਕੂਲ ਕਾਲਜਾਂ ਦਫ਼ਤਰਾਂ ਵਿੱਚ ਵਿੱਚ ਵੀ ਰੰਗੋਲੀ ਬਣਾਈ ਜਾਂਦੀ ਹੈ ਸੂਰਜ ਨੂੰ ਪਾਣੀ ਚੜ੍ਹਾਉਣਾ ਸੂਰਜ ਨੂੰ ਸਵੇਰੇ ਉੱਠਦੇ ਹੀ ਲੋਕ ਸੂਰਜ ਨੂੰ ਪਾਣੀ ਤਾਂ ਦਿੰਦੇ ਹਨ ਤਾਂ ਜੋ ਉਹਨਾਂ ਦੇ ਗ੍ਰਹਿ ਸ਼ਹੀ ਤਰੀਕੇ ਨਾਲ਼ ਚੱਲਣ ਮੱਥੇ 'ਤੇ ਸੰਧੂਰ ਪਾਉਣਾ ਵਿਆਹ ਤੋਂ ਬਾਅਦ ਹਰ ਵਿਆਹੀ ਕੁੜੀ ਆਪਣੇ ਮੱਥੇ 'ਤੇ ਸੰਧੂਰ ਪਾਉਂਦੀ ਹੈ ਕਿਉਂਕਿ ਇਹ ਸਿੱਖ ਧਰਮ ਦਾ ਨਿਸ਼ਾਨੀ ਹੁੰਦੀ ਹੈ ਹਰ ਸਿੱਖ ਕੁੜੀ ਮੱਥੇ 'ਤੇ ਸੰਧੂਰ ਪਾਉਂਦੀ ਹੈ ਹਰ ਕੁੜੀ ਵਿਆਹ ਤੋਂ ਬਾਅਦ ਵਰਤ ਵੀ ਰੱਖਦੀ ਹੈ ਸਵੇਰੇ ਵਰਤ ਸ ਸਵੇਰੇ ਵਰਤ ਉੱਠਦੇ ਹੀ ਰੱਖਿਆ ਜਾਂਦਾ ਹੈ ਪਰ ਸਾਰਾ ਦਿਨ ਕੁਝ ਕੁਝ ਨਾ ਖਾਧਾ ਜਾਂਦਾ ਹੈ ਨਾ ਹੀ ਕੁਝ ਪੀਤਾ ਜਾਂਦਾ ਹੈ ਨਾ ਹੀ ਕੁਝ ਪੀਤਾ ਜਾਂਦਾ ਹੈ ਅਤੇ ਉਹ ਰਾਤ ਨੂੰ ਸੂਰਜ ਨੂੰ ਦੇਖਣ ਤੋਂ ਬਾਅਦ ਵਰਤ ਤੋੜਦੀ ਹੈ